ਮੇਰੀ ਸਭ ਤੋਂ ਯਾਦਗਾਰੀ ਯਾਤਰਾ ਜੈਪੁਰ ਦੀ ਸੀ ਪਿਛਲੇ ਸਾਲ ਅਸੀਂ ਦਿਸੰਬਰ ਦੇ ਵਿੱਚ ਗਏ ਸੀਗੇ ਜੈਪੁਰ ਕਿਉਂਕਿ ਮੇਰੀ ਜਿਹੜੀ ਬੈਸਟ ਫਰੈਂਡ ਸੀ ਉਹਦੀ ਡੈਸਟੀਨੇਸ਼ਨ ਵੈਡਿੰਗ ਸੀ ਜੈਪੁਰ ਅਤੇ ਉਹਦੇ ਲਈ ਅਸੀਂ ਮਤਲਬ ਮੈਂ ਜਿਹੜਾ ਹੈ ਉੱਥੇ ਗਈ ਅਤੇ ਇੱਥੋਂ ਮੈਂ ਬਾਏ ਏਅਰ ਗਈ ਹਾਂ ਜੈਪੁਰ ਦੀ ਜਦੋਂ ਅਸੀਂ ਚਲੋ ਮਤਲਬ ਮੈਂ ਅਰਲੀ ਮੋਰਨਿੰਗ ਹੀ ਪੁੱਜੀ ਹਾਂ ਅਤੇ ਹੋਟਲ ਦੇ ਵਿੱਚ ਉਹਨਾਂ ਨੇ ਬੁਕਿੰਗ ਕਰਵਾਈ ਹੋਈ ਸੀਗੀ ਉੱਥੇ ਮੈਂ ਚਲੋ ਥੋੜ੍ਹਾ ਫਰੈਸ਼ ਹੋ ਕੇ ਅਤੇ ਮੈਂ ਜਦੋਂ ਮੈਰਿਜ 'ਤੇ ਗਈ ਹਾਂ ਉਹਦੇ ਫੰਕਸ਼ਨਸ ਇੱਕ ਦੋ ਸਟਾਰਟ ਹੋ ਚੁੱਕੇ ਸੀਗੇ ਬਟ ਫਿਰ ਹਲਦੀ ਵਾਲਾ ਸੀਗਾ ਉਹਦੇ ਮਤਲਬ ਫਿਰ ਮਹਿੰਦੀ ਲੱਗਣੀ ਸੀ ਅਤੇ ਉਸ ਤੋਂ ਬਾਅਦ ਰਾਤ ਦਾ ਜਿਹੜਾ ਉਹਨਾਂ ਨੇ ਇੱਕ ਸਪੈਸ਼ਲ ਜਿਹੜਾ ਕੀਤਾ ਸੀ ਜਾਗੋ ਦਾ ਮਤਲਬ ਓ ਉਹ ਫੰਕਸ਼ਨ ਜਿਹੜਾ ਸੀਗਾ ਇਹ ਸਾਰੇ ਬਹੁਤ ਵਧੀਆ ਸੀਗੇ ਮੈਂ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਔਰ ਥੋੜ੍ਹੀ ਮਤਲਬ ਫਿਰ ਅਗਲੇ ਦਿਨ ਜਿਹੜਾ ਉਹਦੀ ਵੈਡਿੰਗ ਦਾ ਸੀਗਾ ਉਹ ਵੈਡਿੰਗ ਡਿਸਟੀਨੇਸ਼ਨ ਜਿਹੜੀ ਸੀ ਬਹੁਤ ਹੀ ਮਤਲਬ ਵਧੀਆ ਤਰ੍ਹਾਂ ਡੈਕੋਰੇਟ ਕੀਤੀ ਹੋਈ ਸੀਗੀ ਅਤੇ ਜਿਹੜੇ ਗੈਸਟ ਅਟੈਂਡ ਕਰਨ ਲਈ ਵੀ ਮਤਲਬ ਬਹੁਤ ਵਧੀਆ ਸਿਸਟਮ ਸੀਗਾ ਉਹਨਾਂ ਦਾ ਅਤੇ ਖਾਣਾ ਜਿਹੜਾ ਉੱਥੇ ਬਹੁਤ ਵਧੀਆ ਸੀਗਾ ਸਭ ਤੋਂ ਵੱਧ ਕਿ ਜਿਹੜੇ ਮਤਲਬ ਜਦੋਂ ਬਰਾਤ ਆਈ ਹੈ ਮਤਲਬ ਉੱਥੇ ਜਿਹੜੇ ਮਤਲਬ ਹੋਏ ਉਹਨਾਂ ਦੀ ਕਿਉਂਕਿ ਹਿੰਦੂ ਸੀਗੇ ਵਰਮਾਲਾ ਹੋਈ ਤੀ ਔਰ ਉਹਨਾਂ ਨੇ ਜਿਹੜੇ ਫੇਰੇ ਸੀ ਉਹ ਕਾਫੀ ਟਾਈਮ ਲੱਗਣਾ ਸੀ ਬਟ ਫਿਰ ਵੀ ਇੱਕ ਮਤਲਬ ਦੂਜੇ ਕਲਚਰ ਨੂੰ ਜਿਹੜਾ ਹੈ ਸਮਝਣਾ ਉਹਨੂੰ ਦੇਖਣਾ ਇੰਜੋਏ ਕੀਤਾ ਮੈਂ ਬਹੁਤ ਹੀ ਵਧੀਆ ਲੱਗਾ ਅਤੇ ਜਦੋਂ ਡੋਲੀ ਤੁਰੀ ਅਤੇ ਮੈਂ ਥੋੜ੍ਹੀ ਜਿਹੀ ਇਮੋਸ਼ਨਲ ਵੀ ਹੋ ਗਈ ਕਿਉਂਕਿ ਮੇਰੀ ਬੈਸਟ ਫਰੈਂਡਸ ਸੀਗੀ ਸੋ ਇਹ ਮੇਰੇ ਲਈ ਬਹੁਤ ਹੀ ਵਧੀਆ ਯਾਤਰਾ ਸੀਗੀ ਅਤੇ ਮੇਰੇ ਲਈ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ